ਇਹ ਕੁਦਰਤੀ ਤੌਰ 'ਤੇ ਦੇਖੋ ਜੇ ਕੋਈ ਕਹੇ ਵੀ ਤੁਸੀਂ ਮੇਰੇ ਲਈ ਇਹ ਲਿਖ ਦਿਓ ਜਾਂ ਉਹ ਲਿਖ ਦਿਓ ਉਹ ਉਦਾਂ ਨਹੀਂ ਲਿਖਿਆ ਜਾ ਸਕਦਾ ਕਿਉਂਕਿ ਦਿਮਾਗ ਦੀ ਕੁਦਰਤੀ ਉਪਜ ਹੁੰਦੀ ਹੈ ਜੋ ਤੁਹਾਡੇ ਦਿਮਾਗ ਦੇ ਵਿੱਚ ਕੁਦਰਤ ਤੌਰ 'ਤੇ ਆਉਂਦਾ ਹੈ ਜੇਕਰ ਤੁਸੀਂ ਉਹਨੂੰ ਲਿਖਦੇ ਹੋ ਤਾਂ ਉਹ ਇੱਕ ਵੱਖਰਾ ਰੰਗ ਦੇ ਕੇ ਜਾਂਦਾ ਹੈ ਅਤੇ ਉਹ ਵੱਖਰੀ ਹੀ ਕਿਸਮ ਦਾ ਇੱਕ ਤੁਹਾਡੇ ਮਨ ਨੂੰ ਸਕੂਨ ਵੀ ਦਿੰਦਾ ਹੈ ਇਸ ਕਰਕੇ ਮੇਰਾ ਮੰਨਣਾ ਇਹ ਹੈ ਵੀ ਤੁਸੀਂ ਕਿਸੇ ਦੇ ਕਹੇ ਤੋਂ ਨਾ ਤਾਂ ਲਿਖ ਸਕਦੇ ਹੋ ਅਤੇ ਨਾ ਹੀ ਉਹ ਚੀਜ਼ ਚੰਗੀ ਤਰ੍ਹਾਂ ਲਿਖੀ ਜਾ ਸਕ ਸਕਦੀ ਹੈ ਹਾਂ ਇੱਕ ਗੱਲ ਮੈਂ ਸਹਿਮਤ ਜ਼ਰੂਰ ਹਾਂ ਜੇ ਕਿਸੇ ਦਾ ਕੋਈ ਜਨਮਦਿਨ ਹੈ ਜਾਂ ਫਿਰ ਕਿਸੇ ਦੇ ਵਿਆਹ ਦੀ ਵਰੇਗੰਡ ਹੈ ਇਸ ਦੇ ਮੁੱਖ ਤੌਰ 'ਤੇ ਤੁਸੀਂ ਉਹਨਾਂ ਲਈ ਕੁਝ ਚਾਰ ਸ਼ਬਦ ਜਾਂ ਕੋਈ ਕਵਿਤਾ ਜਾਂ ਕੋਈ ਗੀਤ ਦੇ ਰੂਪ ਵਿੱਚ ਉਹਨਾਂ ਲਈ ਲਿਖ ਸਕਦੇ ਹੋ ਉਹਦੇ ਲਈ ਕੁਝ ਤੁਹਾਨੂੰ ਉਹ ਵੀ ਕਿਸੇ ਜਿਵੇਂ ਤੁਹਾਡਾ ਕੋਈ ਖਾਸ ਬੰਦੇ ਹੋਣ ਜਾਂ ਕੋਈ ਹੋਰ ਤੁਹਾਡੇ ਦਿਲ ਦੇ ਬਹੁਤ ਨੇੜੇ ਹੋਣ ਉਹਨਾਂ ਲਈ ਇੱਦਾਂ ਦੀਆਂ ਰਚਨਾਵਾਂ ਤੁਸੀਂ ਲਿਖ ਸਕਦੇ ਹੋ ਅਤੇ ਜੇਕਰ ਤੁਸੀਂ ਸਪੈਸ਼ਲ ਕਹੋ ਵੀ ਹਾਂ ਉਹਨਾਂ 'ਤੇ ਕੋਈ ਦੇਖ ਕੇ ਗੀਤ ਜਾਂ ਕੋਈ ਗਜ਼ਲ ਜਾਂ ਕੋਈ ਕਵੀ ਕਵਿਤਾ ਲਿਖੀ ਜਾਵੇ ਇਵੇਂ ਤਾਂ ਕਦੇ ਨਹੀਂ ਲਿਖਿਆ ਜਾ ਸਕਦਾ ਜੋ ਮੇਰਾ ਮੰਨਣਾ ਹੈ ਕੁਦਰਤੀ ਉਪਜ ਦੇ ਤੌਰ 'ਤੇ ਹੀ ਲਿਖਿਆ ਜਾ ਸਕਦਾ